ਹੈਲੋ ਨਮਸਤੇ ਮੈਂ ਅੰਜਲੀ ਕੀ ਤੁਸੀਂ ਅਮਨ ਟਰੈਵਲ ਤੋਂ ਬੋਲਦੇ ਹੋ ਮੈਂ ਅਨੰਦਪੁਰ ਸਾਹਿਬ ਜਾਣਾ ਸੀ ਕੱਲ੍ਹ ਕੀ ਤੁਸੀਂ ਤੁਹਾਡੀ ਕਾਰ ਹੈ ਤਾਂ ਤੁਸੀਂ ਸਾਡੇ ਅਤੇ ਸਾਡੇ ਪਰਿਵਾਰ ਨੂੰ ਪਰਿਵਾਰ ਨੂੰ ਅਨੰਦਪੁਰ ਸਾਹਿਬ ਛੱਡ ਸਕਦੇ ਹੋ ਅਸੀਂ ਅਨੰਦਪੁਰ ਸਾਹਿਬ ਮੱਥਾ ਟੇਕਣ ਜਾਣਾ ਹੈ ਕੀ ਕੱਲ੍ਹ ਤੁਸੀਂ ਸੱਤ ਵਜੇ ਤੋਂ ਪਹਿਲਾਂ ਪਹਿਲਾਂ ਸਾਨੂੰ ਅਨੰਦਪੁਰ ਸਾਹਿਬ ਛੱਡ ਸਕਦੇ ਹੋ ਕਿਉਂਕਿ ਉੱਥੇ ਬਹੁਤ ਹੀ ਰੱਸ਼ ਪੈ ਜਾਂਦਾ ਹੈ ਤਾਂ ਕਰਕੇ ਸਾਨੂੰ ਜਲਦੀ ਤੋਂ ਜਲਦੀ ਸੱਤ ਵਜੇ ਤੋਂ ਪਹਿਲਾਂ ਅਨੰਦਪੁਰ ਸਾਹਿਬ ਪਹੁੰਚਾ ਦਿਓ ਤੁਹਾਡਾ ਜਿੰਨਾਂ ਵੀ ਕਿਰਾਇਆ ਹੋਇਆ ਅਸੀਂ ਦੇ ਦੇਵਾਂਗੇ ਤੁਸੀਂ ਸਾਨੂੰ ਜਲਦੀ ਤੋਂ ਜਲਦੀ ਬਸ ਅਨੰਦਪੁਰ ਸਾਹਿਬ ਪਹੁੰਚਾ ਦਿਓ ਧੰਨਵਾਦ